ਪੰਜ ਨਵੰਬਰ ਦੋ ਹਜ਼ਾਰ ਤੇਈ ਚਾਰ ਅਕਤੂਬਰ ਦੋ ਹਜ਼ਾਰ ਤੇਈ ਅੱਠ ਨਵੰਬਰ ਦੋ ਹਜ਼ਾਰ ਤੇਈ ਦਸ ਦਸੰਬਰ ਦੋ ਹਜ਼ਾਰ ਤੇਈ ਇੱਕ ਅਕਤੂਬਰ ਦੋ ਹਜ਼ਾਰ ਤੇਈ